ਜਿੱਥੇ ਤੱਕ ਸਿੱਖਿਆ ਪ੍ਰਣਾਲੀ ਦੀ ਗੱਲ ਕਰੀਏ ਸਿੱਖਿਆ ਪ੍ਰਣਾਲੀ ਅੱਜ ਤੋਂ ਕੁਛ ਸਾਲ ਪਹਿਲੇ ਬਹੁਤ ਹੀ ਵਧੀਆ ਨਹੀਂ ਸੀਗੀ ਪਰ ਜਿਸ ਤਰ੍ਹਾਂ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕਰ ਲਈਏ ਸਰਕਾਰੀ ਸਕੂਲਾਂ ਦਾ ਇੱਕ ਤਾਂ ਸਟਕਚਰ ਬਹੁਤ ਹੀ ਘਟੀਆ ਸੀਗਾ ਔਰ ਪੜ੍ਹਾਈ ਵੀ ਬਿਲਕੁਲ ਬਹੁਤ ਹੀ ਘੱਟ ਸੀ ਸਿਲੇਬਸ ਵੀ ਬਹੁਤ ਘੱਟ ਸੀ ਔਰ ਬੱਚਿਆਂ ਨੂੰ ਮਤਲਬ ਕਿ ਇੰਨੀ ਉਹਨਾਂ ਦੀ ਉਹਨਾਂ ਦੀ ਨੌਲੇਜ 'ਚ ਇੰਨਾ ਵਾਧਾ ਨਹੀਂ ਸੀ ਹੋ ਰਿਹਾ ਹੁਣ ਸਰਕਾਰ ਨੇ ਕਾਫੀ ਅੱਛੀ ਇਸ ਇਸ ਚੀਜ਼ ਨੂੰ ਕਾਫੀ ਸੁਧਾਰ ਕਰ ਦਿੱਤਾ ਸਿੱਖਿਆ ਵਿੱਚ ਕਾਫੀ ਸੁਧਾਰ ਕਰਤਾ ਸਕੂਲ ਇੰਨੇ ਅੱਛੇ ਬਣਾ ਦਿੱਤੇ ਆ ਟੀਚਰ ਵੀ ਵਧੀਆ ਵਧੀਆ ਲਗਾ ਦਿੱਤੇ ਆ ਕਿਉਂਕਿ ਜਿਹੜੇ ਪੜ੍ਹੇ ਲਿਖੇ ਟੀਚਰ ਆ ਉਹ ਹੀ ਅੱਗੋਂ ਬੱਚਿਆਂ ਨੂੰ ਅੱਛੀ ਤਰ੍ਹਾਂ ਮਤਲਬ ਕਰਵਾ ਸਕਦੇ ਆ ਮਤਲਬ ਪੜ੍ਹਾਈ ਦੇ ਨਾਲ ਨਾਲ ਬੱਚੇ ਜਿਸ ਤਰ੍ਹਾਂ ਥਿਊਰੀ ਹੈ ਕਰਵਾਉਂਦੇ ਹੈ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਦੀ ਵੀ ਜ਼ਰੂਰਤ ਹੁੰਦੀ ਹੈ ਮਤਲਬ ਪ੍ਰੈਕਟੀਕਲ ਨਾਲ ਵੀ ਬੱਚਾ ਉਹਨੂੰ ਪ੍ਰੈਕਟੀਕਲ ਜਦੋਂ ਹੋਏਗਾ ਉਹਦੇ ਨਾਲ ਉਹ ਬੱਚੇ ਨੂੰ ਬੱਚੇ ਦੀ ਨੌਲੇਜ ਜ਼ਿਆਦਾ ਵੱਧਦੀ ਆ ਥਿਊਰੀ ਦੇ ਨਾਲ ਨਾਲ ਅਤੇ ਉਹ ਸਰਕਾਰ ਕਾਫੀ ਅੱਛਾ ਕਰ ਰਹੀ ਹੈ ਪਹਿਲੇ ਨਾਲੋਂ ਬਹੁਤ ਹੀ ਵਧੀਆ ਸਰਕਾਰ ਨੇ ਕਰ ਦਿੱਤਾ ਸ਼ਹਿਰਾਂ ਵਿੱਚ ਤਾਂ ਸ਼ ਖੈਰ ਪਹਿਲੇ ਵੀ ਕੁਛ ਅੱਛੇ ਸੀਗੇ ਲੇਕਿਨ ਪਿੰਡਾਂ ਦਾ ਮਾਹੌਲ ਜ਼ਿਆਦਾ ਸੀਗਾ ਪਿੰਡਾਂ ਦੇ ਸਕੂਲਾਂ ਦਾ ਜ਼ਿਆਦਾ ਹਾਲਤ ਖ਼ਰਾਬ ਸੀ ਹੁਣ ਪਿੰਡਾਂ ਵਿੱਚ ਵੀ ਕਾਫੀ ਸਰਕਾਰ ਨੇ ਕਰ ਦਿੱਤਾ ਪਿੰਡਾਂ ਵਿੱਚ ਕਾਫੀ ਅੱਛਾ ਹੋ ਚੁੱਕਾ ਹੁਣ ਥਿਊਰੀ ਪ੍ਰੈਕਟੀਕਲ ਵੀ ਹੋ ਰਹੇ ਆ ਮਤਲਬ ਕਿ ਲੈਬ ਵਿੱਚ ਲੈਬ ਵਿੱਚ ਬਹੁਤ ਵਧੀਆ ਕਰਵਾਉਂਦੇ ਹੈ ਹੁਣ ਬਹੁਤ ਅੱਛਾ ਚੱਲ ਰਿਹਾ